ਭਾਅ ਜੀ ਆਪਣੇ ਜਿੱਦਾਂ ਸਰਕਾਰੀ ਹੋਸਪਿਟਲਾਂ 'ਚ ਘੱਟ ਜਾਂ ਡਲੀਵਰੀ ਚੰਗੀ ਤਰ੍ਹਾਂ ਨਹੀਂ ਕਰਦੇ ਪ੍ਰਾਈਵੇਟ 'ਚ ਡਲੀਵਰੀ ਜਿੱਦਾਂ ਲੇਡੀਜ਼ ਦੀ ਡਲੀਵਰੀ ਕਰਦੇ ਆ ਪ੍ਰਾਈਵੇਟ 'ਚ ਵਧੀਆ ਢੰਗ ਤਰੀਕੇ ਨਾਲ ਕਰਦੇ ਆ ਜਦ ਜਨਾਨੀ ਦੇ ਪੇਨ ਹੁੰਦੀ ਹੈ ਇੰਜੈਕਸ਼ਨ ਲਾਉਂਦੇ ਆ ਸਰਕਾਰੀ ਆ ਸਰਕਾਰੀ ਵਾਲੇ ਤਾਂ ਦੇਖਭਾਲ ਵੀ ਨਹੀਂ ਕਰਦੇ ਜਨਾਨੀ ਦੀ ਸਰਕਾਰੀ ਜੇ ਪੈਸੇ ਘੱਟ ਲੈਂਦੇ ਆ ਅਤੇ ਦੇਖਭਾਲ ਵੀ ਘੱਟ ਹੀ ਆ ਪ੍ਰਾਈਵੇਟ ਜੇ ਫਾਹੇ ਪੈਸੇ ਜ਼ਿਆਦਾ ਲੈਂਦੇ ਦੇਖਭਾਲ ਵੀ ਵਧੀਆ ਤਰੀਕੇ ਨਾਲ ਕਰਦੇ ਲੇਡੀਜ਼ ਦੀ ਠੀਕ ਹੈ ਅਤੇ ਬੱਚਿਆਂ ਦੀ ਕੀ ਦੇਖ ਭਾਲ ਕਰਦੇ ਬੱਚਿਆਂ ਦੇ ਸਰਕਾਰੀ 'ਚ ਅਤੇ ਬੱਚਿਆਂ ਕੋਈ ਸਹੂਲਤ ਹੈ ਹੀ ਨਹੀਂ ਸਰਕਾਰੀ ਵਾਲੀ 'ਚ ਹੁਣ ਪ੍ਰਾਈਵੇਟ 'ਚ ਜੇ ਬੱਚਿਆਂ ਦੇ ਹੋਸਪਿਟਲ ਬਣੇ ਆ ਜਾਂ ਲੇਡੀ ਦੀ ਡਲੀਵਰੀ ਹੁੰਦੀ ਬੱਚਾ ਹੁੰਦਾ ਉਹ ਸਰਕਾਰੀ ਆਲੇ ਥੋੜ੍ਹੀ ਰੱਖ ਸਕਦੇ ਉਹ ਤਾਂ ਉਹ ਜਿਹੜੇ ਛੋਟੇ ਹੋਸਪਿਟਲ ਬਣੇ ਬੱਚਿਆਂ ਦੇ ਉਹ ਤਾਂ ਪਹਿਲਾਂ ਬੱਚਾ ਬੱਚਾ ਜਨਮ ਹੁੰਦਾ ਬੱਚੇ ਦਾ ਪਹਿਲਾਂ ਮਸ਼ੀਨ 'ਚ ਲੈ ਕੇ ਰੱਖਦੇ ਬੱਚੇ ਨੂੰ ਠੀਕ ਹੈ ਕਿਸੇ ਨੂੰ ਪੀਲੀਆ ਹੋ ਜਾਂਦਾ ਬੱਚੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਹ ਪਹਿਲਾਂ ਉਹ 'ਚ ਰੱਖਣਾ ਪੈਂਦਾ ਇੱਕ ਦੋ ਦਿਨ ਬੱਚਿਆਂ ਦੇ ਚਿਲਡਰਨ ਹੋਸਪੀਟਲ ਜਿਹੜੇ ਹੁੰਦੇ ਪ੍ਰਾਈਵੇਟ ਉਹਨਾਂ 'ਚ ਰੱਖਣਾ ਪੈਂਦਾ ਫੇਰ ਜਾ ਕੇ ਬੱਚਾ ਸੈਟ ਕਰਕੇ ਫੇਰ ਬਾਅਦ 'ਚ ਦੁਬਾਰਾ ਬ ਬੱਚਾ ਫੇਰ ਮਾਂ ਕੋਲ ਆਉਂਦਾ ਸਰਕਾਰੀ ਵਾਲੇ 'ਚ ਦੇਖਭਾਲ ਤਾਂ ਹੈ ਹੀ ਨਹੀਂ ਹਜੇ ਪ੍ਰਾਈਵੇਟ ਵਾਲਾ ਜੇ ਬੱਚਾ ਹੁੰਦਾ ਨਾਲੇ ਉਹ ਭੇਜਦੇ ਹੈਗੇ ਉੱਥੇ ਬੱਚਿਆਂ ਦੇ ਹੋਸਪੀਟਲ ਲੈ ਕੇ ਜਾਓ ਬੱਚੇ ਨੂੰ ਵੀ ਇਹਨੂੰ ਕੋਈ ਪੀਲੀਆ ਨਾ ਹੋਵੇ ਇਨਫੈਕਸ਼ਨ ਨਾ ਹੋਵੇ ਬੱਚੇ ਨੂੰ ਸਰਕਾਰੀ ਵਾਲੇ ਦੇਖਦੇ ਨਹੀਂ ਡਿਲੀਵਰੀ ਹੋ ਗਈ ਲੇਡੀ ਦੀ ਅਤੇ ਬੱਚਾ ਰੱਖ ਦਿੰਦੇ ਆ ਨਾ ਦੇਖਣਾ ਉਹ ਨਹੀਂ ਵੇਖ ਕੇ ਆਹ ਵੀ ਹੈਗਾ ਕੀ ਬੱਚੇ ਨੂੰ ਕੀ ਹੋਇਆ ਕੀ ਨਹੀਂ ਆ ਭਾਵੇਂ ਬੱਚਾ ਬਿਮਾਰ ਹੋਵੇ ਬੱਚੇ ਨੂੰ ਭਾਵੇਂ ਪ੍ਰੋਬਲਮ ਕੋਈ ਪ੍ਰੋਬਲਮ ਪੀਲੀਆ ਹੋ ਜੇ ਬੱਚੇ ਨੂੰ ਇਨਫੈਕਸ਼ਨ ਹੋ ਜਾਵੇ ਕੋਈ ਦੇਖਭਾਲ ਨਹੀਂ ਕਰਨੀ ਪ੍ਰਾਈਵੇਟ ਵਾਲੇ ਜੇ ਪੈਸੇ ਜ਼ਿਆਦਾ ਲੈਂਦੇ ਆ ਅਤੇ ਦੇਖ ਭਾਲ ਵੀ ਵਧੀਆ ਤਰੀਕੇ ਨਾਲ ਭਾਜੀ ਕਰਦੇ ਆ ਠੀਕ ਆ ਇੱਦਾਂ ਨਹੀਂ ਕਰਦੇ ਕਿ ਬੱਚੇ ਦਾ ਜਨਮ ਹੋ ਗਿਆ ਬੱਚੇ ਨੂੰ ਉੱਥੇ